ਮੈਂ ਇੱਕ ਵਿਦਿਆਰਥੀ ਹਾਂ ਜੋ ਆਪਣੇ ਘਰ ਤੋਂ ਦੂਰ ਕਿਸੇ ਸ਼ਹਿਰ ਵਿੱਚ ਰਹਿੰਦਾ ਹਾਂ ਹੁੁਣ ਮੈਨੂੰ ਮੇਰਾ ਆਧਾਰ ਕਾਰਡ ਜੋ ਹੈ ਜੋ ਉਸ ਦਾ ਵੇਰਵਾ ਹੈ ਉਸਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ ਮੈਂ ਹੁਣ ਨਵੇਂ ਸ਼ਹਿਰ 'ਚ ਹੈਗਾ ਮੈਂ ਇਸ ਨੂੰ ਅਪਡੇਟ ਕਰਨ ਲਈ ਕਿਹੜੇ ਆਧਾਰ ਕੇਂਦਰ ਵਿੱਚ ਜਾਵਾਂ ਆਪਣੇ ਆਧਾਰ ਵੇਰਵਿਆਂ ਨੂੰ ਅਪਡੇਟ ਕਰਨ ਲਈ ਮੈਂ ਕਿਸ ਤੋਂ ਸਲਾਹ ਮੰਗਾਂ ਹੁਣ ਮੈਂ ਸਲਾਹ ਮੰਗਦਾ ਹਾਂ ਕਿ ਅਪਡੇਟ ਲਈ ਨਜ਼ਦੀਕੀ ਆਧਾਰ ਦਾਖ਼ਲਾ ਕੇਂਦਰ ਕਿੱਥੇ ਲੱਭਿਆ ਜਾਵੇ ਨਵੇਂ ਸ਼ਹਿਰ ਵਿੱਚ ਮੈਂ ਕਿਸੇ ਤੋਂ ਪੁੱਛਦਾ ਹਾਂ ਕਿਸੇ ਤੋਂ ਸਲਾਹ ਲੈਂਦਾ ਹਾਂ ਵੀ ਆਧਾਰ ਜੋ ਕਾਰਡ ਹੈ ਇਸ ਦਾ ਜੋ ਵੇਰਵਾ ਹੈ ਇਸ ਨੂੰ ਕਿਵੇਂ ਅਪਡੇਟ ਕੀਤਾ ਜਾਵੇ ਅਤੇ ਕਿਹੜੇ ਆਧਾਰ ਕੇਂਦਰ ਤੋਂ ਕੀਤਾ ਜਾਵੇ ਆਧਾਰ ਕੇਂਦਰ ਦਾ ਪਤਾ ਪੁੱਛਦਾ ਹਾਂ ਇਸ ਦੇ ਲਈ ਮੈਂ ਸਲਾਹ ਮੰਗਦਾ ਹਾਂ ਅਪਡੇਟ ਲਈ ਨਜ਼ਦੀਕੀ ਆਧਾਰ ਦਾਖ਼ਲਾ ਕੇਂਦਰ ਕਿੱਥੇ ਲੱਭਣਾ ਹੈ ਹੁਣ ਮੈਂ ਕਿੱਥੇ ਲੱਭਾਂ ਮੈਨੂੰ ਤਾਂ ਕੁਛ ਪਤਾ ਹੀ ਨਹੀਂ ਨਵੇਂ ਸ਼ਹਿਰ 'ਚ ਹੁਣ ਮੈਨੂੰ ਇਸ ਦੇ ਲਈ ਸਲਾਹ ਲੈਣੀ ਪੈਣੀ ਹੈ ਆਧਾਰ ਕਾਰਡ ਤੋਂ ਵੇਰਵਾ ਹੈ ਇਸ ਦਾ ਅਪਡੇਟ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਹੁਣ ਆਪਣੇ ਘਰ ਤੋਂ ਬਹੁਤ ਦੂਰ ਹਾਂ ਅਤੇ ਮੈਨੂੰ ਕਰਨਾ ਪੈਣਾ ਹੈ ਅਤੇ ਮੈਨੂੰ ਸਲਾਹ ਲੈਣੀ ਪੈਣੀ ਇਹਦੇ ਲਈ ਅਤੇ ਸਲਾਹ ਹੁਣ ਮੈਂ ਮੰਗ ਰਿਹਾ ਵੀ ਨਜ਼ਦੀਕੀ ਆਧਾਰ ਦਾਖ਼ਲਾ ਕੇਂਦਰ ਕਿੱਥੇ ਲੱਭਣਾ ਹੈ ਮੈਂ ਉੱਥੇ ਜਾ ਕੇ ਆਪਣਾ ਆਧਾਰ ਕਾਰਡ ਅਪਡੇਟ ਕਰਵਾ ਸਕਾਂ ਕਿਉਂਕਿ ਆਧਾਰ ਕਾਰਟ ਹਰ ਥਾਂ 'ਤੇ ਆਧਾਰ ਕਾਰਡ ਦੀ ਜ਼ਰੂਰਤ ਹੁੰਦੀ ਹੈ ਕਿਸੇ ਵੀ ਪ੍ਰੋਗਰਾਮ ਵਿੱਚ ਜਾਂ ਕਿੱਧਰ ਵੀ ਆਉਣਾ ਜਾਣਾ ਹੋਵੇ ਤਾਂ ਉੱਥੇ ਆਧਾਰ ਕਾਰਡ ਦੀ ਤਾਂ ਜ਼ਰੂਰ ਚੈੱਕ ਕਰਦੇ ਹਨ ਆਧਾਰ ਕਾਰਡ ਨੂੰ ਵੇਖੇ ਬਿਨ੍ਹਾਂ ਤਾਂ ਕੁਛ ਹੱਲ ਹੀ ਨਹੀਂ ਹੰਦਾ ਇਸ ਲਈ ਮੈਨੂੰ ਆਪਣਾ ਆਧਾਰ ਕਾਰਡ ਆ ਜੋ ਵੇਰਵਾ ਹੈ ਉਸਨੂੰ ਅਪਡੇਟ ਕਰਨ ਦੀ ਬਹੁਤ ਜ਼ਰੂਰਤ ਹੈ ਦੇ ਲਈ ਨਜ਼ਦੀਕੀ ਆਧਾਰ ਦਾਖ਼ਲਾ ਕੇਂਦਰ ਲੱਭਣਾ ਪੈਣਾ ਦੱਸੋ ਥੈਂਕ